ਭਾਰਤ ਦੀ ਸਰਕਾਰੀ ਭਾਸ਼ਾ ਤਾਂ ਹਿੰਦੀ ਹੈ ਪਰ ਅੰਗਰੇਜ਼ੀ ਨੂੰ ਵੀ ਭਾਰਤ ਵਿੱਚ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਉਸਦਾ ਮੂਲ ਕਾਰਨ ਇਹ ਲੱਗਦਾ ਹੈ ਕਿ ਭਾਰਤ ਵਰਸ਼ ਲਗਭਗ ਡੇਢ ਸੌ ਸਾਲ ਅੰਗਰੇਜ਼ਾਂ ਦੇ ਅਤੇ ਬ੍ਰਿਟਿਸ਼ ਸਰਕਾਰ ਦੇ ਅਧੀਨ ਰਿਹਾ ਹੈ ਭਾਰਤ ਦੀ ਰਾਸ਼ਟਰੀ ਭਾਸ਼ਾ ਜਿਹਨੂੰ ਨੈਸ਼ਨਲ ਲੈਂਗੁਏਜ ਕਹਿੰਦੇ ਉਹ ਤਾਂ ਹਿੰਦੀ ਹੈ ਪਰ ਪ੍ਰਾਂਤਾਂ ਦੇ ਭਾਰਤ ਦੇ ਪ੍ਰਾਂਤਾਂ ਵਿੱਚ ਉੱਤਰ ਤੋਂ ਦੱਖਣ ਅਤੇ ਪੂਰਵ ਤੋਂ ਪੱਛਮ ਤੱਕ ਬਹੁਤ ਹੀ ਭਿੰਨਤਾ ਹੈ ਜਿਹਨੂੰ ਕਿ ਆਪਾਂ ਅੰਗਰੇਜ਼ੀ ਵਿੱਚ ਡਾਇਵਰਸਿਟੀ ਵੀ ਕਹਿੰਦੇ ਹਾਂ ਇਸ ਵਿਭਿੰਨਤਾ ਕਾਰਨ ਲਗਭਗ ਸਾਰੇ ਹੀ ਪ੍ਰਾਂਤਾਂ ਦੀਆਂ ਰਾਜਾਂ ਦੀਆਂ ਆਪਣੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਵੀ ਹਨ ਜਿਨਾਂ ਨੂੰ ਅਸੀਂ ਸਟੇਟ ਲੈਂਗੁਏਜ ਜਾਂ ਲੋਕਲ ਲੈਂਗੁਏਜ ਜਾਂ ਸਥਾਨਕ ਭਾਸ਼ਾ ਵੀ ਕਹਿੰਦੇ ਹਾਂ ਜਿਵੇਂ ਕਿ ਤਮਿਲਨਾਡੂ ਵਿੱਚ ਤਮਿਲ ਕਰਨਾਟਕਾ ਵਿੱਚ ਕੰਨੜ ਗੁਜਰਾਤ ਵਿੱਚ ਗੁਜਰਾਤੀ ਮਹਾਰਾਸ਼ਟਰ ਵਿੱਚ ਮਰਾਠੀ ਅਤੇ ਪੰਜਾਬ ਵਿੱਚ ਪੰਜਾਬੀ ਆਦਿ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜੋ ਕੇਂਦਰ ਸਰਕਾਰ ਅਤੇ ਲਗਭਗ ਸਾਰੇ ਕੰਮਾਂ ਵਿੱਚ ਅਤੇ ਖੇਤਰਾਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ ਪਰ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਆਪਣੇ ਆਪਣੇ ਸਥਾਨਕ ਭਾਸ਼ਾਵਾਂ ਵਿੱਚ ਹੀ ਕੰਮ ਕਰਦੀਆਂ ਹਨ ਇਸਦਾ ਮਤਲਬ ਇਹ ਹੈ ਕਿ ਵੱਖਰੇ ਵੱਖਰੇ ਰਾਜਾਂ ਦੀਆਂ ਜਾਂ ਪ੍ਰਾਂਤਾਂ ਦੀਆਂ ਸਰਕਾਰਾਂ ਆਪਣੇ ਵਿਭਾਗਾਂ ਵਿੱਚ ਸੂਚਨਾ ਦੇਣ ਲਈ ਜਾਂ ਆਮ ਜਨਤਾ ਨੂੰ ਨੋਟਿਸ ਸੂਚਨਾ ਜਾਂ ਇਸ਼ਤਿਹਾਰ ਦੇਣ ਲਈ ਸਥਾਨਕ ਭਾਸ਼ਾਵਾਂ ਦਾ ਵੀ ਪ੍ਰਯੋਗ ਕਰਦੀਆਂ ਹਨ ਇਹ ਇੱਕ ਬਹੁਤ ਹੀ ਵਧੀਆ ਗੱਲ ਹੈ ਕਿ ਅਸੀਂ ਬਹੁਤ ਸਾਰੇ ਭਾਸ਼ਾਵਾਂ ਅਤੇ ਵਿਭਿੰਨਤਾ ਕਾਰਨ ਵੀ ਅਸੀਂ ਸਾਰੇ ਭਾਰਤੀ ਹਾਂ ਅਤੇ ਏਕਤਾ ਵਿੱਚ ਹਾਂ